ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਇੰਨਾਂ ਸੁਧਾਰ ਹੋਇਆ ਹੈ ਕਿ ਕੁਝ ਸਥਾਨਕ ਵਾਤਾਵਰਨ ਸੰਬੰਧੀ ਜਿਹੜੇ ਜਿਹੜੇ ਪਾਰਕ ਬਣੇ ਨੇ ਉਹਨਾਂ ਦੀ ਵਿਵਸਥਾ ਦੱਸ ਰਹੀ ਹਾਂ ਜਿਸ ਤਰ੍ਹਾਂ ਇੱਕ ਨੰਬਰ ਮਾਧੋਪੁਰ ਤੋਂ ਸੁਜਾਨਪੁਰ ਤੱਕ ਨਹਿਰ ਦੇ ਕਿਨਾਰੇ ਕਿਨਾਰੇ ਕਮੇਟੀ ਵਾਲਿਆਂ ਨੇ ਸੜਕ ਵਧੀਆ ਬਣਾ ਦਿੱਤੀ ਹੈ ਲੋਕਾਂ ਲਈ ਸੈਰ ਕਰਨ ਲਈ ਅਜਿਹੀ ਕਾਰਜਕਾਰੀ ਕੀਤੀ ਹੈ ਕਿ ਆਸੇ ਪਾਸੇ ਵਾਤਾਵਰਨ ਨੂੰ ਸੁਖਾਲਾ ਬਣਾਉਣ ਲਈ ਬੂਟੇ ਵਗੈਰਾ ਲਗਾ ਕੇ ਵਧੀਆ ਜਗ੍ਹਾ ਬਣਾ ਦਿੱਤੀ ਹੈ ਇਸ ਤੋਂ ਅੱਗੇ ਜਾ ਕੇ ਜਾਂਦਿਆਂ ਹੀ ਸੁਜਾਨਪੁਰ ਚਾਰ ਨੰਬਰ ਪੰਜ ਨੰਬਰ ਦੇ ਵਿਚਕਾਰ ਇੱਕ ਵਧੀਆ ਜੋ ਕਿ ਬਿਲਕੁਲ ਬੇਜਾਨ ਜਗ੍ਹਾ ਸੀ ਸਰਕਾਰ ਨੇ ਕਮੇਟੀ ਦੇ ਨਾਲ ਮਿਲ ਕਰਕੇ ਇੱਕ ਵਧੀਆ ਪਾਰਕ ਬਣਾ ਦਿੱਤਾ ਹੈ ਜਿਹੜਾ ਕਿ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਲੋਕਾਂ ਨੂੰ ਸੈਰ ਕਰਨ ਲਈ ਘੁੰਮਣ ਫਿਰਨ ਲਈ ਯੋਗ ਬਣਾ ਦਿੱਤਾ ਹੈ ਇਸ ਤੋਂ ਇਲਾਵਾ ਥੋੜ੍ਹੀ ਹੋਰ ਅੱਗੇ ਜਾ ਕੇ ਕਾਠ ਦੇ ਪੁੱਲ 'ਤੇ ਪਠਾਨਕੋਟ ਦਰੂਵ ਪਾਰਕ ਬਣਾ ਬਣ ਚੁੱਕਿਆ ਹੈ ਜਿਹੜਾ ਬੱਚਿਆਂ ਲਈ ਘੁੰਮਣ ਫਿਰਨ ਲਈ ਫੁੱਲ ਬੂਟੇ ਅਤੇ ਝੂਲੇ ਵਗੈਰਾ ਲਗਾਏ ਗਏ ਹਨ ਇਸ ਦੀ ਦੇਖ ਰੇਖ ਲਈ ਸਾਡੀ ਭਾਰਤੀ ਫੌਜ ਕਰਦੀ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਤਾਂ ਇਹ ਹੋਰ ਵੀ ਵਧੀਆ ਪਵਿੱਤਰ ਬਣ ਜਾਵੇਗਾ ਮੈਂ ਇਹ ਗੱਲ ਕਵਾਂਗੀ ਕਿ ਕੁਦਰਤ ਦੇ ਨਾਲ ਵਾਤਾਵਰਨ ਦੀ ਅਥਾਹ ਪਿਆਰ ਹੈ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਆਪਣੇ ਆਪਣੇ ਜਨਮ ਦਿਨ 'ਤੇ ਮਿਲ ਕੇ ਇੱਕ ਇੱਕ ਬੂਟਾ ਲਗਾਈਏ